ਚੁਰੰਜਾ ਪੰਜ ਸੌ ਸਤਾਹਠ ਛੇ ਹਜ਼ਾਰ ਸੱਤ ਸੌ ਚੁਰਾਸੀ ਚੌਂਤੀ ਹਜ਼ਾਰ ਪੰਜ ਸੌ ਛਿਆਸੀ ਤਿੰਨ ਲੱਖ ਚੌਵੀ ਹਜ਼ਾਰ ਪੰਜ ਸੌ ਗਿਆਰਾਂ